ਬਿਜਲੀ ਵਿੱਚ ਦੋ ਤਰ੍ਹਾਂ ਦੇ ਕਰੰਟ ਪਾਏ ਜਾਂਦੇ ਹਨ ਏ ਸੀ ਕਰੰਟ ਅਤੇ ਡੀ ਸੀ ਕਰੰਟ ਅਤੇ ਇਹਨਾਂ ਵਿੱਚੋਂ ਡੀ ਸੀ ਕਰੰਟ ਦਾ ਜ਼ਿਆਦਾ ਖਤਰਾ ਹੈ ਅਤੇ ਨੋਰਮਲ ਘਰਾਂ ਵਿੱਚੋਂ ਡੀ ਸੀ ਕਨਵਰਟ ਕਰਨ ਤੋਂ ਆ ਏ ਸੀ ਕਰੰਟ ਕਨਵਰਟ ਹੁੰਦਾ ਹੈ ਅਤੇ ਮੇਨ ਜਿਵੇਂ ਕਿ ਪਲੱਗ ਵਿੱਚ ਕਨੈਕਸ਼ਨ ਕਰੰਟ ਆਉਣਾ ਅਤੇ ਸੀ ਬੀ ਆਫ ਕਰਨਾ ਗਿੱਲੇ ਕੱਪੜਿਆਂ ਤੋਂ ਨੂੰ ਤੂੰ ਤਾਰ ਤੋਂ ਬਿਜਲੀ ਤਾਰ ਤੋਂ ਬਚਾਉਣਾ ਅਤੇ ਬੱਚਿਆਂ ਨੂੰ ਇਹਨਾਂ ਤੋਂ ਪਰੇ ਰੱਖਣਾ ਅਤੇ ਗ਼ਲਤ ਤਾਰਾਂ ਦਾ ਕਨੈਕਸ਼ਨ ਜੋੜਨਾ